ਪੋਲਟਰੀ ਕਾਰੋਬਾਰ ਦੀਆਂ ਆਮ ਚਣੌਤੀਆਂ ਅਤੇ ਉਹਨਾਂ ਦੇ ਹੱਲ ਇਹ ਹਨ ਪੋਲਟਰੀ ਕਾਰੋਬਾਰ ਕਰਦੇ ਸਮੇਂ ਕਈ ਕਿਸਮ ਦੀਆਂ ਚੁਣੌਤੀਆਂ ਆਉਂਦੀਆਂ ਹਨ ਜੋ ਕਿ ਹਰੇਕ ਨਵਾਂ ਜਾਂ ਮੌਜੂਦਾ ਪੋਲਟਰੀ ਫਾਰਮਰ ਨੂੰ ਜਾਣਨੀਆਂ ਚਾਹੀਦੀਆਂ ਹਨ ਕੁਝ ਮੁੱਖ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਇਹ ਹੋ ਸਕਦੇ ਨੇ ਪਹਿਲਾ ਬਿਮਾਰੀਆਂ ਅਤੇ ਸੰਕਰਮਣ ਚੁਣੌਤੀ ਮੁਰਗੀਆਂ ਵਿੱਚ ਰਾਣੀ ਖੇਤ ਬਰਡ ਫਲਿਊ ਅਤੇ ਹੋਰ ਬਿਮਾਰੀਆਂ ਫੈਲਣ ਦਾ ਖਤਰਾ ਇਹਦਾ ਹੱਲ ਇਹ ਹੈ ਕਿ ਨਿਯਮਿਤ ਵੈਕਸੀਨੇਸ਼ਨ ਕਰਵਾਉਂਦੇ ਰਹਿਣਾ ਚਾਹੀਦਾ ਹੈ ਦੂਸਰਾ ਖੁਰਾਕ ਦੀ ਵਧਦੀ ਕੀਮਤ ਚੁਨੌਤੀ ਮੁਰਗੀਆਂ ਦੀ ਪੋਸ਼ਣ ਯੋਗ ਖੁਰਾਕ ਦੀ ਕੀਮਤ ਵਧਦੀ ਰਹਿੰਦੀ ਹੈ ਜਿਸ ਕਾਰਨ ਲਾਭ ਘੱਟ ਜਾਂਦਾ ਹੈ ਹਲ ਘਰ ਵਿੱਚ ਕੁਝ ਔਰਗੈਨਿਕ ਜਾਂ ਹਰੇ ਪੱਤੀਆਂ ਵਾਲਾ ਖੁਰਾਕ ਵਰਤਣੀ ਚਾਹੀਦੀ ਹੈ